ਹਾਂਜੀ ਜਿਵੇਂ ਕਿ ਪੰਜਾਬ ਵਿੱਚ ਦਿਵਾਲੀ ਦਾ ਤਿਉਹਾਰ ਉਸ ਵਿੱਚ ਮੈਂ ਮਾਤਾ ਲੱਛਮੀ ਜੀ ਦੀ ਮੂਰਤੀ ਬਣਾਈ ਉਸ ਦੀ ਪੂਜਾ ਕੀਤੀ ਉਸਨੂੰ ਮੈਂ ਆਪਣੇ ਹੱਥਾਂ ਨਾਲ ਬਹੁਤ ਸੋਹਣਾ ਪੇਂਟ ਕੀਤਾ ਬਹੁਤ ਸੋਹਣਾ ਸਜਾਇਆ ਅਤੇ ਉਸ 'ਤੇ ਬੜਾ ਸੋਹਣੇ ਚੁੰਨਰੀ ਦਿੱਤੀ ਉਸ ਨੂੰ ਬਣਾਉਣ ਨਾਲ ਮੈਨੂੰ ਬਹੁਤ ਹੀ ਆਨੰਦ ਆਇਆ ਅਤੇ ਜਿਵੇਂ ਕਿ ਗਣੇਸ਼ ਚਤੁਰਥੀ ਆਉਂਦੀ ਆ ਤੇ ਅਤੇ ਉਸ ਦੀ ਮੂਰਤੀ ਗਣੇਸ਼ ਜੀ ਦੀ ਬਣਾ ਕੇ ਉਸ ਦੀ ਪੂਜਾ ਕੀਤੀ ਬਹੁਤ ਚੰਗਾ ਲੱਗਿਆ ਉਹਦੇ ਉੱਤੇ ਬਹੁਤ ਸੋਹਣੇ ਕਲਰ ਬਣਾਏ ਅਤੇ ਉਸਦੀ ਮਹੀਨਾ ਇੱਕ ਪੂਜਾ ਕਰਨ ਤੋਂ ਬਾਅਦ ਉਸ ਦਾ ਵਿਸਰਜਨ ਕੀਤਾ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਇਹ ਮੂਰਤੀਆਂ ਸਾਰੀਆਂ ਬਾਜ਼ਾਰ ਵਿੱਚੋਂ ਵੀ ਮਿਲਦੀਆਂ ਹਨ ਲੇਕਿਨ ਮੇਰੇ ਆਪਣੇ ਹੱਥਾਂ ਵਿੱਚ ਇਹ ਕਲਾ ਹੈਗੀ ਆ ਮੈਨੂੰ ਮੂਰਤੀਆਂ ਬਣਾਉਣਾ ਤਿਉਹਾਰਾਂ ਤੇ ਮੌਕੇ 'ਤੇ ਬਹੁਤ ਵਧੀਆ ਲੱਗਦਾ ਹੈ ਮੈਂ ਆਪਣੇ ਹੱਥਾਂ ਨਾਲ ਬਣਾ ਕੇ ਇਹਨਾਂ ਨੂੰ ਸਜਾ ਕੇ ਬੜਾ ਆਨੰਦ ਆਉਂਦਾ ਹੈ ਅਤੇ ਜਿਸ ਤਰ੍ਹਾਂ ਕਿ ਜਨਮ ਅਸ਼ਟਮੀ ਦੇ ਮੌਕੇ 'ਤੇ ਅਸੀਂ ਕ੍ਰਿਸ਼ਨ ਜੀ ਦੀ ਮੂਰਤੀ ਬਣਾਈ ਅਤੇ ਉਹਨਾਂ ਦਾ ਝੂਲਾ ਬਣਾਇਆ ਅਤੇ ਉਹਨਾਂ ਨੂੰ ਝੂਲਾ ਝੁਲਾਇਆ ਇਹ ਸਭ ਕਰਕੇ ਸਾਨੂੰ ਬਹੁਤ ਅਨੰਦ ਆਉਂਦਾ ਹੈ ਅਤੇ ਮੂਰਤੀਆਂ ਬਣਾਉਣ ਦਾ ਅਨੁਭਵ ਬਹੁਤ ਵਧੀਆ ਹੈ ਸਾਡੇ ਕੋਲ